ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪੁੱਛੋ ਹਾਂਜੀ ਇਹਦੇ ਵਿੱਚ ਤੁਸੀਂ ਹੁਣ ਪ੍ਰੈਗਨੈਂਸੀ ਦਾ ਥਰਡ ਮੰਥ ਤੁਹਾਡਾ ਚਲਦਾ ਪਿਆ ਤੁਸੀਂ ਭਾਰੀ ਕੰਮ ਬਿਲਕੁਲ ਨਹੀਂ ਕਰਨਾ ਨਾ ਪੌੜੀਆਂ ਚੜਨੀਆਂ ਔਰ ਤੁਸੀਂ ਆਪਣਾ ਪੂਰਾ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਿਆ ਕਰੋ ਹਰੀ ਸਬਜ਼ੀਆਂ ਜਿੱਦਾਂ ਫਰੂਟ ਵਗੈਰਾ ਖਾਇਆ ਕਰੋ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹੋਰ ਕੋਈ ਪ੍ਰੋਬਲਮ ਹੈਗੀ ਤੁਹਾਨੂੰ ਹਾਂਜੀ ਹਾਂਜੀ ਉਹ ਤੁਸੀਂ ਆਪਣਾ ਰੈਗੂਲਰ ਚੈਕਅਪ ਕਰਵਾਉਂਦੇ ਰਹੋ ਹਾਂਜੀ ਰੈਗੂਲਰ ਚੈਕਅਪ ਕਰਵਾਉਂਦੇ ਰਹੋ ਥਰਡ ਮੰਥ ਔਰ ਫਿਫਥ ਮੰਥ 'ਚ ਤੁਹਾਨੂੰ ਅਲਟਰਾਸਾਉਂਡ ਵੀ ਕਹੇ ਹੋਣੇ ਆ ਉਹ ਵੀ ਤੁਸੀਂ ਆਪਣੇ ਕਰਵਾਓ ਨਾਈਨ ਹਾਂਜੀ ਨਾਈਨ ਮੰਥ ਤੱਕ ਤੁਹਾਨੂੰ ਤਿੰਨ ਅਲਟਰਾਸਾਊਂਡ ਕਰਵਾਉਣੇ ਆ ਆਪਣੇ ਹਾਂਜੀ ਅਤੇ ਬਾਕੀ ਤੁਸੀਂ ਆਇਰਨ ਕੈਲਸ਼ੀਅਮ ਦੇ ਟੈਬਲਟਸ ਲੈਂਦੇ ਪਏ ਹੋ ਅੱਛਾ ਹਾਂਜੀ ਉਹ ਪੂਰੇ ਆਪਣੇ ਕੰਟੀਨਿਊ ਰੱਖੋ ਨੌ ਮੰਥ ਤੱਕ ਮੈਂ ਕਿਹਾ ਨੌ ਮੰਥ ਤੱਕ ਉਹ ਤੁਸੀਂ ਕੰਟੀਨਿਊ ਰੱਖੋ ਆਇਰਨ ਔਰ ਕੈਲਸ਼ੀਅਮ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਕਰਵਾ ਸਕਦੇ ਹੋ ਆਪਣਾ ਵੈਸੇ ਹਰ ਹਰ ਮੰਥ ਤੁਸੀਂ ਆਪਣਾ ਚੈਕਅਪ ਵਗੈਰਾ ਕਰਵਾਇਆ ਕਰੋ ਬਾਕੀ ਇਹੀ ਹੈ ਕਿ ਭਾਰ ਵਗੈਰਾ ਨਾ ਚੁੱਕਿਆ ਕਰੋ ਆਪਣਾ ਥੋੜ੍ਹਾ ਰੈਸਟ ਦੇ ਵੱਲ ਸਾਈਡ ਜ਼ਿਆਦਾ ਧਿਆਨ ਦੇਵੋ ਪਰ ਬਾਕੀ ਆਪਣਾ ਖਾਣ ਪੀਣ ਠੀਕ ਰੱਖੋ ਹਰੀ ਸਬਜ਼ੀਆਂ ਖਾਓ ਫਰੂਟਸ ਖਾਓ ਹਾਂਜੀ ਤੁਹਾਨੂੰ ਬੈਂਗਣ ਵਗੈਰਾ ਬਿਲਕੁਲ ਨਹੀਂ ਖਾਣੇ ਤੁਸੀਂ ਪਾਲਕ ਪਾਲਕ ਜ਼ਿਆਦਾ ਖਾਓ ਬਾਕੀ ਹੋਰ ਸਬਜ਼ੀਆਂ ਖਾਓ ਤੁਸੀਂ ਬਸ ਗਰਮ ਚੀਜ਼ਾਂ ਬੇਸ਼ੱਕ ਨਾ ਖਾਇਆ ਕਰੋ ਵੈਸੇ ਤਾਂ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆ ਤੁਸੀਂ ਥੋੜ੍ਹੀ ਥੋੜ੍ਹੀ ਤਾਂ ਖਾ ਹੀ ਸਕਦੇ ਹੋ ਹਾਂਜੀ ਠੀਕ ਹੈ ਠੀਕ ਹੈ ਕਦੇ ਵੀ ਤੁਸੀਂ ਕੋਲ ਕਰ ਸਕਦੇ ਹੋ ਓਕੇ ਓਕੇ ਥੈਂਕ ਯੂ